ਵਾਕ ਵਿੱਚ ਵਰਤੇ ਗਏ ਵਿਆਕਰਨਿਕ ਵਰਗ ਜਿਵੇਂ ਨਾਂਵ ਵਿਸ਼ੇਸ਼ਣ ਕਿਰਿਆ ਸੰਬੰਧਕ ਯੋਜਕ ਅਤੇ ਵਿਸਮਿਕ ਦੇ ਸੂਚਕ ਸ਼ਬਦ ਜਾਂ ਸ਼ਬਦ ਸਮੂਹ ਨੂੰ ਵਾਕੰਸ਼ ਕਿਹਾ ਜਾਂਦਾ ਹੈ ਵਾਕੰਸ਼ ਬਹੁਤ ਤਰ੍ਹਾਂ ਦੇ ਹੁੰਦੇ ਹਨ ਜੋ ਕਿ ਅਸੀਂ ਆਪਣੇ ਰੋਜ਼ਾਨਾ ਜਿੰਦਗੀ ਵਿੱਚ ਇਸਤੇਮਾਲ ਕਰਦੇ ਹਾਂ ਜਿਹਨਾਂ ਵਿੱਚੋਂ ਕੁਝ ਉਦਾਹਰਨਾਂ ਹਨ ਉੱਲੂ ਬਾਟਾ ਜਿਸ ਦਾ ਅਰਥ ਬੇਵਕੂਫ ਹੈ ਜਿਵੇਂ ਕਿ ਸਾਡੇ ਘਰਾਂ ਵਿੱਚ ਆਮ ਤੌਰ 'ਤੇ ਹੀ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਹਨ ਕਿ ਮੇਰਾ ਜਵਾਕ ਤਾਂ ਉੱਲੂ ਬਾਟਾ ਹੈ ਭਾਵ ਬੇਵਕੂਫ ਹੈ ਇਵੇਂ ਹੀ ਊਲ ਜਲੂਲ ਜਿਸ ਦਾ ਅਰਥ ਬਕਵਾਸ ਬੋਲਣਾ ਹੈ ਅਕਲ ਦਾ ਅੰਨਾ ਮੂਰਖ ਲਈ ਵਰਤਿਆ ਜਾਂਦਾ ਹੈ ਅਤੇ ਆਟੇ ਵਿੱਚ ਲੂਣ ਭਾਵ ਬਹੁਤ ਘੱਟ ਮਾਤਰਾ ਨੂੰ ਬਿਆਨ ਕਰਨ ਲਈ ਵਰਤਿਆ ਜਾਂਦਾ ਹੈ ਇਸੇ ਤਰ੍ਹਾਂ ਸੋਨੇ ਦਾ ਅੰਡਾ ਜੋ ਕਿ ਬਹੁਤ ਕੀਮਤੀ ਵਸਤੂ ਲਈ ਵਰਤਿਆ ਜਾਂਦਾ ਹੱਟਾ ਕੱਟਾ ਤਕੜੇ ਸਰੀਰ ਲਈ ਕਲਮ ਦਾ ਧਨੀ ਜੋ ਕਿ ਇੱਕ ਬਹੁਤ ਹੀ ਪ੍ਰਸਿੱਧ ਵਾਕੰਸ਼ ਹੈ ਜੋ ਕਿ ਇੱਕ ਚੰਗੇ ਲਿਖਾਰੀ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਭਾਈ ਵੀਰ ਸਿੰਘ ਕਮਲ ਕਲਮ ਦੇ ਧਨੀ ਸਨ ਇਸੇ ਤਰ੍ਹਾਂ ਕਿਤਾਬੀ ਕੀੜਾ ਉਸ ਲਈ ਵਰਤਿਆ ਜਾਂਦਾ ਹੈ ਜਿਹੜਾ ਹਮੇਸ਼ਾ ਪੜ੍ਹੀ ਜਾਵੇ ਧੰਨਵਾਦ